ਚੰਗੇ ਅਧਿਆਪਕ ਗੁਣਾਂ ਦੇ ਧਾਰਨੀ ਹੁੰਦੇ ਹਨ ਸਭ ਤੋਂ ਪਹਿਲਾਂ ਜੋ ਜ਼ਰੂਰੀ ਗੁਣ ਹੈ ਉਹ ਸਹਿਣਸ਼ੀਲਤਾ ਹੈ ਇੱਕ ਚੰਗੇ ਅਧਿਆਪਕ ਵਿੱਚ ਸਹਿਣਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਗੁਣ ਹੈ ਜਿਸ ਦੇ ਨਾਲ਼ ਉਹ ਬੱਚਿਆਂ ਨੂੰ ਵਧੀਆ ਤਰੀਕੇ ਨਾਲ਼ ਸਿਖਾ ਸਕਦਾ ਅਤੇ ਬੱਚੇ ਹੋਰ ਸਿੱਖਣ ਦੇ ਵਿੱਚ ਧਿਆਨ ਲਗਾਉਂਦੇ ਹਨ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਇਹ ਚੰਗੇ ਅਧਿਆਪਕ ਨੂੰ ਹਮਦਰਦੀ ਭਰਿਆ ਵਿਵਹਾਰ ਬੱਚਿਆਂ ਦੇ ਨਾਲ਼ ਕਰਨਾ ਚਾਹੀਦਾ ਹੈ ਜਦੋਂ ਉਹ ਬੱਚਿਆਂ ਦੇ ਨਾਲ਼ ਹਮਦਰਦੀ ਦਿਖਾਉਂਦਾ ਤਾਂ ਬੱਚੇ ਆਪਣੀ ਪ੍ਰੋਬਲਮਸ ਨੂੰ ਲੈ ਕੇ ਸਮੱਸਿਆਵਾਂ ਨੂੰ ਲੈ ਕੇ ਅਧਿਆਪਕ ਕੋਲ ਬਿਨਾਂ ਝਿਜਕਾਏ ਔਰ ਸ਼ਰਮਾਏ ਉਹ ਟੀਚਰ ਕੋਲ ਜਾਂਦੇ ਹਨ ਅਤੇ ਆਪਣੀ ਆਪਣੀ ਪ੍ਰੋਬਲਮਸ ਦਾ ਹੱਲ ਪੁੱਛਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹ ਅਧਿਆਪਕ ਹੀ ਹੁੰਦੇ ਹਨ ਜੋ ਬੱਚਿਆਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਕਿਉਂਕਿ ਜੋ ਜੋ ਬੱਚੇ ਅੱਜ ਪੜ੍ਹ ਰਹੇ ਨੇ ਉਹਨਾਂ ਨੇ ਕੱਲ੍ਹ ਨੂੰ ਦੁਨੀਆਂ ਦੇ ਉੱਤੇ ਰਾਜ ਕਰਨਾ ਅਤੇ ਉਹ ਲੀਡਰ ਨੇ ਸਾਡੇ ਭਵਿੱਖ ਦੇ ਲੀਡਰ ਨੇ ਉਹ ਅਤੇ ਬੱਚਿਆਂ ਦੇ ਭਵਿੱਖ ਦੇ ਵਿੱਚ ਅਧਿਆਪਕ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਸਮਝਿਆ ਜਾਂਦਾ ਏ